ਜੋ ਕੰਮ ਪਹਿਲਾਂ ਪਿੰਡਾਂ 'ਚ ਜਾ ਪੁਰਾਣੇ ਟਾਈਮ 'ਤੇ ਹੁੰਦੇ ਸਨ ਉਹ ਅੱਜ ਦੁਬਾਰਾ ਸ਼ੁਰੂ ਹੋ ਗਏ ਹਨ ਜਿੱਦਾਂ ਕਿ ਮਿੱਟੀ ਦੇ ਬਰਤਨ ਮਿੱਟੀ ਦੇ ਬਰਤਨਾਂ 'ਚ ਖਾਣਾ ਪਿੱਤਲ ਦੇ ਬਰਤਨ ਪਿੱਤਲ ਦੇ ਬਰ ਬਰਤਨਾਂ 'ਚ ਬਣਾਉਣਾ ਤਾਂ ਤਾਂਬੇ ਦੇ ਬ ਬਰਤਨ ਆ ਆ ਆਉਣ ਲੱਗ ਪਏ ਨੇ ਪਾਣੀ ਪੀਣ ਵਾਸਤੇ ਪਾਣੀ ਰੱਖਣ ਵਾਸਤੇ

ਕਰ ਰਿਹਾ ਹੈ ਲੋਕ ਆਪਣੀ ਪੁਰਾਣੀ ਵਿਰਾਸਤ ਨਾਲ ਜੁੜਨਾ ਸ਼ੁਰੂ ਹੋ ਗਏ ਹਨ